ਅੱਜ ਦੇ ਸੰਸਾਰ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣੌਤੀਆਂ ਨਹੀਂ ਮੈ ਤਾਂ ਕਹਿ ਦਿੰਦੀ ਹਾਂ ਕਿ ਮੁਸ਼ਕਿਲਾਂ ਦਾ ਹੀ ਕਹਿ ਲਓ ਸਾਹਮਣਾ ਕਰਨਾ ਪੈਂਦਾ ਕਿਉਂਕਿ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਨੂੰ ਹਿੰਦੀ ਅਤੇ ਇੰਗਲਿਸ਼ ਦੇ ਮੁਕਾਬਲੇ ਚੰਗਾ ਨਹੀਂ ਸਮਝਿਆ ਜਾਂਦਾ ਅਤੇ ਪੰਜਾਬੀ ਨੂੰ ਜ਼ਿਆਦਾਤਰ ਲੋਕ ਸਮਝਦੇ ਆ ਕਿ ਇਹ ਅਨਪੜ੍ਹਾਂ ਦੀ ਭਾਸ਼ਾ ਕਿਉਂਕਿ ਇਹ ਆਪਣੀ ਮਾਂ ਬੋਲੀ ਹੈ ਇਹ ਤਾਂ ਕਿਸੇ ਨੂੰ ਮਤਲਬ ਫਰਕ ਹੀ ਨਹੀਂ ਹੁਣ ਪੈਂਦਾ ਕਿ ਆਪਣੀ ਮਾਂ ਬੋਲੀ ਹੈ ਕਿ ਇਹਨੂੰ ਅਸੀਂ ਸਾਂਭ ਕੇ ਰੱਖਣਾ ਸਾਡਾ ਵਿਰਸਾ ਹੈ ਇਹਨੂੰ ਅੱਗੇ ਲੈ ਕੇ ਜਾਣਾ ਅੱਜ ਦੇ ਮਾਤਾ ਪਿਤਾ ਆਪਣੇ ਬੱਚੇ ਨੂੰ ਪੰਜਾਬੀ ਭਾਸ਼ਾ ਦੀ ਥਾਂ 'ਤੇ ਹਿੰਦੀ ਜਾਂ ਇੰਗਲਿਸ਼ ਮਤਲਬ ਬੁਲਾਉਣ ਦੇ ਵਿੱਚੋਂ ਮਾਣ ਮਹਿਸੂਸ ਕਰਦੇ ਨੇ ਬਹੁਤ ਸ਼ਰਮ ਦੀ ਗੱਲ ਹੈ ਪੰਜਾਬੀਆਂ ਲਈ ਜੇ ਤੁਹਾਨੂੰ ਸੀ ਬੀ ਐਸ ਈ ਵਾਲੇ ਆਈ ਸੀ ਐਸ ਸੀ ਵਾਲੇ ਕੋਈ ਵੀ ਬੋਰਡ ਆ ਕੋਈ ਵੀ ਸਕੂਲ ਹੈ ਤੁਹਾਨੂੰ ਕਹਿੰਦਾ ਹੈ ਵੀ ਨਹੀਂ ਤੁਸੀਂ ਆਪਣੇ ਬੱਚੇ ਨੂੰ ਹਿੰਦੀ ਬੁਲਵਾਓ ਆਪਣੇ ਬੱਚੇ ਨੂੰ ਇੰਗਲਿਸ਼ ਬੁਲਵਾਓ ਤਾਂ ਤੁਸੀਂ ਉੱਥੇ ਜਾ ਕੇ ਇਹ ਕਹਿ ਸਕਦੇ ਹੋ ਕਿ ਤੁਸੀਂ ਸਾਡੇ ਬੱਚੇ ਨੂੰ ਆਹ ਦੋ ਲੈਂਗੁਏਜ ਸਿਖਾ ਸਕਦੇ ਹੋ ਪਰ ਅਸੀਂ ਪੰਜਾਬੀ ਨਹੀਂ ਛੱਡਣੀ ਤੁਸੀਂ ਸਾਡੇ ਬੱਚੇ ਨੂੰ ਪੰਜਾਬੀ ਬੋਲਣ 'ਤੇ ਰੋਕ ਨਹੀਂ ਲਾ ਸਕਦੇ ਸਕੂਲਾਂ 'ਚ ਜਾ ਕੇ ਉਹਨਾਂ ਪ੍ਰਿੰਸੀਪਲਾਂ ਨੂੰ ਇਹ ਇੱਕ ਸੁਝਾਅ ਦਿੱਤਾ ਜਾ ਸਕਦਾ ਕਿ ਇੱਕ ਪੀਰੀਅਡ ਦੇ ਵਿੱਚ ਪੰਜਾਬੀ ਵਾਲੇ ਪੀਰੀਅਡ ਦੇ ਵਿੱਚ ਤਾਂ ਬੱਚੇ ਚੰਗੀ ਤਰ੍ਹਾਂ ਪੰਜਾਬੀ ਬੋਲ ਲੈਣ ਤੁਹਾਨੂੰ ਪਤਾ ਕਈ ਸਕੂਲਾਂ 'ਚ ਤਾਂ ਇਸ ਗੱਲ 'ਤੇ ਜ਼ੁਰਮਾਨਾ ਬੱਚਿਆਂ 'ਤੇ ਲਾ ਦਿੰਦੇ ਨੇ ਵੀ ਤੁਸੀਂ ਇੰਗਲਿਸ਼ 'ਚ ਗੱਲ ਕਰਨੀ ਹੈ ਤੁਸੀਂ ਹਿੰਦੀ 'ਚ ਗੱਲ ਕਰਨੀ ਹੈ ਤੁਸੀਂ ਪੰਜਾਬੀ 'ਚ ਗੱਲ ਨਹੀਂ ਕਰਨੀ ਅਤੇ ਇਹ ਇਹ ਤਾਂ ਰਹੀ ਸਕੂਲਾਂ ਦੀ ਗੱਲ ਬਾਹਰ ਜਾ ਕੇ ਵੀ ਬਹੁਤ ਪ੍ਰੋਬਲਮਸ ਨੇ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਕਿਉਂਕਿ ਜ਼ਿਆਦਾਤਰ ਜਿਹੜਾ ਨੋਟੀਫਿਕੇਸ਼ਨਸ ਹੁੰਦੇ ਨੇ ਉਹ ਜਾਂ ਤਾਂ ਇੰਗਲਿਸ਼ 'ਚ ਹੁੰਦੇ ਨੇ ਜਾਂ ਹਿੰਦੀ 'ਚ ਹੁੰਦੇ ਨੇ ਸੋ ਪੰਜਾਬੀ ਲਈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪੰਜਾਬੀ ਭਾਸ਼ਾ ਨੂੰ ਵੀ ਅੱਗੇ ਲੈ ਕੇ ਜਾਣਾ ਚਾਹੀਦਾ ਕਿਉਂਕਿ ਇਹ ਸਾਡੀ ਮਾਤ ਬੋਲੀ ਹੈ ਧੰਨਵਾਦ